ਮਾਰਸ਼ਲ ਆਰਟਸ ਬਾਰੇ ਜਦੋਂ ਵੀ ਗੱਲ ਕੀਤੀ ਜਾਂਦੀ ਹੈ ਤਾਂ ਇਹ ਸਿਰਫ ਇੱਕ ਸਰੀਰਿਕ ਕਲਾਕਾਰੀ ਨਹੀਂ ਹੁੰਦੀ ਬਲਕਿ ਇਸ ਦਾ ਮਾਨਸਿਕ ਅਤੇ ਆਤਮਿਕ ਵਿਕਾਸ ਨਾਲ ਵੀ ਹੁੰਦਾ ਹੈ ਮਾਰਸ਼ਲ ਆਰਟਸ ਸਿਖਾਉਣ ਅਤੇ ਸਿੱਖਣ ਦਾ ਮੁੱਖ ਉਦੇਸ਼ ਸਿਰਫ ਲੜਾਈ ਦੇ ਤਰੀਕੇ ਸਿਖਾਉਣਾ ਨਹੀਂ ਹੁੰਦਾ ਬਲਕਿ ਇਸ ਦਾ ਮੁੱਖ ਉਦੇਸ਼ ਆਤਮ ਰੱਖਿਆ ਆਤਮ ਵਿਕਾਸ ਅਤੇ ਆਤਮ ਨਿਯੰਤਰਣ ਹੈ ਇਸ ਵਿੱਚ ਦੱਸਿਆ ਜਾਂਦਾ ਹੈ ਕਿ ਆਪਾਂ ਆਪਣੇ ਆਤਮ ਸੁਰੱਖਿਆ ਕਿਵੇਂ ਕਰ ਸਕਦੇ ਹਾਂ ਆਪਦੇ ਅੰਦਰ ਵਿਕਾਸ ਕਿਵੇਂ ਕੀਤਾ ਜਾ ਸਕਦਾ ਹੈ ਅਤੇ ਆਪਦੇ ਗੁਸੇ 'ਤੇ ਕੰਟਰੋਲ ਕਿਵੇਂ ਕਰ ਸਕਦੇ ਹਾਂ ਮਾਰਸ਼ਲ ਆਰਟ ਸਿੱਖਣ ਨਾਲ ਇੱਕ ਵਿਅਕਤੀ ਆਪਣੇ ਦੁਸ਼ਮਣਾਂ ਨੂੰ ਪਰੇਸ਼ਾਨ ਕਰਨ ਦੀ ਥਾਂ ਉਹਨਾਂ ਨਾਲ ਸੰਬੰਧਿਤ ਸਮੱਸਿਆਵਾਂ ਦਾ ਸਮੱਸਿਆਵਾਂ ਦਾ ਹੱਲ ਢੂੰਢਣਾ ਸਿਖਦਾ ਹੈ ਇਸ ਕਲਾ ਵਿੱਚ ਇਹ ਇੱਕ ਅਹਿਮ ਪਹਿਲੂ ਸਹੀ ਸਮੇਂ 'ਤੇ ਸਹੀ ਫੈਸਲੇ ਲੈਣਾ ਹੁੰਦਾ ਹੈ ਜੋ ਕਿ ਸਿਰਫ ਯੁੱਧ ਕਲਾ ਵਿੱਚ ਹੀ ਨਹੀਂ ਬਲਕਿ ਜੀਵਨ ਦੇ ਹਰ ਪਹਿਲੂ ਵਿੱਚ ਮਦਦਗਾਰ ਹੁੰਦਾ ਹੈ ਇਹ ਵਿਅਕਤੀ ਨੂੰ ਸ਼ਾਂਤ ਅਤੇ ਸਮਰਪਿਤ ਰੱਖਣ ਵਿੱਚ ਮਦਦ ਕਰਦਾ ਹੈ ਜਿਸ ਨਾਲ ਉਹ ਮਾਨਸਿਕ ਤੌਰ 'ਤੇ ਮਜ਼ਬੂਤ ਬਣਦਾ ਹੈ ਇਸ ਦੇ ਨਾਲ ਬੰਦਾ ਆਪਣੇ ਗੁੱਸੇ 'ਤੇ ਵੀ ਕੰਟਰੋਲ ਕਰ ਸਕਦਾ ਹੈ ਅਤੇ ਆਪਦੇ ਅੰਦਰ ਆਤਮ ਵਿਸ਼ਵਾਸ ਵੀ ਜਗਾ ਸਕਦਾ ਹੈ ਇਸ ਦੇ ਨਾਲ ਹੀ ਅ ਮਾਰਸ਼ਲ ਆਰਟ ਸਿੱਖਣ ਨਾਲ ਸ਼ਕਤੀ ਪ੍ਰਦਾਨ ਕਰਨ ਦੀ ਯੋਗਿਤਾ ਵੀ ਵਿਕਸਿਤ ਹੁੰਦੀ ਹੈ ਇੱਕ ਵਿਅਕਤੀ ਜਦੋਂ ਮਾਰਸ਼ਲ ਆਰਟਸ ਸਿੱਖਦਾ ਹੈ ਤਾਂ ਉਹ ਸਰੀਰਕ ਤਾਕਤ ਚੁਸਤੀ ਸਮਰਥਾ ਵਿੱਚ ਵਾਧਾ ਕਰਦਾ ਹੈ ਇਹ ਇਹ ਸਿਰਫ ਉਸ ਦੀ ਸੁਰੱਖਿਆ ਲਈ ਨਹੀਂ ਬਲਕਿ ਸਮਾਜ ਲਈ ਵੀ ਪੋਜ਼ੀਟਿਵ ਰੋਲ ਨਿਭਾਉਣ ਲਈ ਮਦਦਗਾਰ ਹੁੰਦਾ ਹੈ ਇਸ ਕਲਾ ਨਾਲ ਇੱਕ ਵਿਅਕਤੀ ਨੂੰ ਆਪਣੇ ਸਰੀਰ 'ਤੇ ਕੰਟਰੋਲ ਸਮਰਪਣ ਅਤੇ ਸਹਿਣਸ਼ੀਲਤਾ ਬਾਰੇ ਸਿੱਖਣ ਨੂੰ ਮਿਲਦਾ ਹੈ ਉਸ ਨੂੰ ਮਾਰਸ਼ਲ ਆਰਟਸ ਨਾਲ ਕਾਫੀ ਕੁਛ ਸਿੱਖਣ ਨੂੰ ਮਿਲਦਾ ਹੈ ਮਾਰਸ਼ਲ ਆਰਟਸ ਸਿਖਾਉਣ ਵਾਲੇ ਅਧਿਆਪਕ ਵੀ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਇਹ ਕਿਲ ਕਲਾ ਸਿਰਫ ਯੁੱਧ ਲਈ ਨਹੀਂ ਹੈ ਇਹ ਆਪਣੇ ਮਿੱਤਰਾਂ ਨੂੰ ਬੇ ਆਪਣੇ ਆਪ ਨੂੰ ਬਿਹਤਰ ਬਣਾਉਣ ਆਪਣੇ ਮਨ ਅਤੇ ਸਰੀਰ ਨੂੰ ਨਿਯੰਤਰਿਤ ਕਰਨ ਅਤੇ ਸਮਾਜ ਵਿੱਚ ਸ਼ਾਂਤੀ ਅਤੇ ਸਮਰਥਨ ਫੈਲਾਉਣ ਲਈ ਹੈ ਮਾਰਸ਼ਲ ਆਰਟ ਦੇ ਸਿਧਾਂਤ ਵਿੱਚ ਸਿਖਾਇਆ ਜਾਂਦਾ ਹੈ ਯੁੱਧ ਤਦ ਤੱਕ ਹੀ ਕੀਤਾ ਜਾਣਾ ਚਾਹੀਦਾ ਹੈ ਜਦੋਂ ਹਰ ਕੋਈ ਵਿਕਲਪ ਨਹੀਂ ਹੁੰਦਾ ਆਪਾਂ ਨੂੰ ਪਹਿਲਾਂ ਹਰ ਇੱਕ ਬੰਦੇ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ ਇਸ ਨਾਲ ਇੱਕ ਵਿਅਕਤੀ ਨੂੰ ਸਹਿਣਸ਼ੀਲਤਾ ਦਇਆ ਅਤੇ ਸਮਰਪਣ ਦਾ ਮਹੱਤਵ ਸਿੱਖਣ ਨੂੰ ਮਿਲਦਾ ਹੈ ਇਹ ਕਲਾ ਸਿੱਖਣ ਨਾਲ ਵਿਅਕਤੀ ਆਪਣੇ ਅੰਦਰ ਆਤਮ ਨਿਯੰਤਰਣ ਸਮਰਪਣ ਸਹਿਣਸ਼ੀਲਤਾ ਦਾ ਵਿਕਾਸ ਕਰਦਾ ਹੈ ਇਹ ਉਸ ਨੂੰ ਸਿਰਫ ਆਪਣੇ ਦੁਸ਼ਮਣਾਂ ਤੋਂ ਸੁਰੱਖਿਆ ਪ੍ਰਦਾਨ ਨਹੀਂ ਕਰਦੀ ਬਲਕਿ ਉਸ ਨੂੰ ਆਪਣਾ ਸਰੀਰ ਅਤੇ ਮਨ 'ਤੇ ਮਜ਼ਬੂਤ ਬਣਾ ਕੇ ਆਪਣੇ ਜੀਵਨ ਵਿੱਚ ਸਫਲ ਬਣਾਉਂਦੀ ਹੈ ਇਸ ਲਈ ਮਾਰਸ਼ਲ ਆਰਟ ਨੂੰ ਸਿਰਫ ਯੁੱਧ ਕਲਾ ਦੇ ਤੌਰ 'ਤੇ ਨਹੀਂ ਬਲਕਿ ਜੀਵਨ ਦੇ ਹਰ ਪਹਿਲੂ ਵਿੱਚ ਲਾਗੂ ਕਰਨ ਵਾਲੀ ਕਲਾ ਦੇ ਤੌਰ 'ਤੇ ਦੇਖਣਾ ਚਾਹੀਦਾ ਹੈ ਇਹ ਸਿਰਫ ਆਪਾਂ ਨੂੰ ਯੁੱਧ ਕਰਨਾ ਨਹੀਂ ਸਿਖਾਉਂਦੀ ਬਲਕਿ ਆਪਣੇ ਜੀਵਨ ਦੇ ਵਿੱਚ ਬਹੁਤ ਕਿਵੇਂ ਬਦਲਾਅ ਲੈ ਕੇ ਆਉਣੇ ਹੈ ਉਸ ਵਿੱਚ ਵੀ ਇਹ ਮਦਦਗਾਰ ਸਾਬਿਤ ਹੁੰਦੀ ਹੈ ਮਾਰਸ਼ਲ ਆਰਟ ਸਿੱਖਣ ਨਾਲ ਮਿਲਣ ਵਾਲੇ ਲਾਭ ਸਿਰਫ ਸਰੀਰਿਕ ਤਾਕਤ ਵਿੱਚ ਸੀਮਿਤ ਨਹੀਂ ਹੁੰਦੇ ਇਹ ਵਿਅਕਤੀ ਦੇ ਮਨ ਨੂੰ ਸ਼ਾਂਤ ਅਤੇ ਨਿਯੰਤਰਿਤ ਕਰਦੇ ਹਨ ਇਸ ਨਾਲ ਵਿਅਕਤੀ ਨੂੰ ਆਪਣੇ ਜੀਵਨ ਵਿਚ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੀ ਯੋਗਿਤਾ ਮਿਲਦੀ ਹੈ